ਮੈਂ ਹਰ ਰੋਜ਼ ਯੋਗਾ ਦੀ ਇੱਕ ਪ੍ਰਕਾਰ ਅਸ਼ਟੰਗਾ ਯੋਗਾ ਕਰਦੀ ਹਾਂ ਇਸ ਦਾ ਭਾਵ ਹੈ ਅੱਠ ਸਿਧਾਂਤਾਂ 'ਤੇ ਅਧਾਰਿਤ ਯੋਗਾ ਦੀ ਇੱਕ ਕਿਸਮ ਅਤੇ ਡੂੰਘੇ ਨਿਯੰਤਰਿਤ ਸਾਹ ਲੈਣ ਦੇ ਨਾਲ ਤੇਜ਼ ਉਧਾਰਿਤ ਵਿੱਚ ਕੀਤੇ ਗਏ ਪੋਜ ਦੀ ਇੱਕ ਲੜੀ ਨੂੰ ਸ਼ਾਮਿਲ ਕਰਦਾ ਹੈ ਇਸ ਯੋਗ ਦੇ ਦੌਰਾਨ ਸਾਨੂੰ ਡੂੰਘੇ ਸਾਹ ਲੈਣੇ ਸਿਖਾਏ ਜਾਂਦੇ ਹਨ ਜੋ ਕਿ ਸਾਡੇ ਦਿਮਾਗ ਦੀ ਇਕਾਗਰਤਾ ਨੂੰ ਵਧਾਉਂਦਾ ਹੈ ਜਦੋਂ ਮੈਂ ਪੜ੍ਹਾਈ ਕਰਦੀ ਹਾਂ ਤਾਂ ਇਹ ਮੇਰੇ ਦਿਮਾਗ ਨੂੰ ਇਕਾਗਰਤਾ ਅਤੇ ਸ਼ਾਂਤ ਰਹਿਣ ਵਿੱਚ ਮਦਦ ਕਰਦਾ ਹੈ ਮੇਰੀ ਆਮ ਜ਼ਿੰਦਗੀ ਵਿੱਚ ਵੀ ਯੋਗਾ ਦਾ ਬਹੁਤ ਬੜਾ ਮਹੱਤਵ ਹੈ ਇਹ ਮੇਰੇ ਦਿਮਾਗ ਨੂੰ ਸ਼ਾਂਤ ਕਰਨ ਵਿੱਚ ਬਹੁਤ ਮਦਦਗਾਰ ਹੈ ਜਦੋਂ ਮੈਂ ਰਾਤ ਨੂੰ ਸੌਂਦੀ ਹਾਂ ਤਾਂ ਮੈਂ ਉਸ ਸਮੇਂ ਵੀ ਆਪਣੀ ਯੋਗਾ ਦੇ ਕਈ ਆਸਣਾਂ ਦਾ ਪਾਲਣ ਕਰਦੀ ਹਾਂ ਜਿਸ ਨਾਲ ਮੇਰਾ ਦਿਮਾਗ ਸ਼ਾਂਤ ਰਹਿੰਦਾ ਹੈ ਅਤੇ ਮੈਨੂੰ ਵਧੀਆ ਨੀਂਦ ਆਉਂਦੀ ਹੈ ਇਸ ਦੇ ਨਾਲ ਮੈਂ ਆਪਣੇ ਜ਼ਿੰਦਗੀ ਵਿੱਚ ਕਰਨ ਵਾਲੇ ਹੋਰ ਕੰਮਾਂ ਵਿੱਚ ਵੀ ਯੋਗਾ ਦਾ ਇਸਤੇਮਾਲ ਕਰਦੀ ਹਾਂ ਯੋਗਾ ਨੇ ਮੇਰੀ ਜ਼ਿੰਦਗੀ ਨੂੰ ਤੇ ਅਤੇ ਮੇਰੇ ਦਿਮਾਗ ਵਿੱਚ ਚੱਲਣ ਵਾਲੇ ਸੋਚਾਂ ਨੂੰ ਵੀ ਕੰਟਰੋਲ ਵਿੱਚ ਲੈ ਕੇ ਆਉਣ ਵਿੱਚ ਮਦਦ ਕੀਤੀ ਹੈ